ਖੇਤੀਬਾੜੀ ਦੇ ਪਾਣੀ ਦੇ ਸਰੋਤ ਹੈ ਇੱਧਰ ਜਿਹੜੇ ਤਾਂ ਜ਼ਿਆਦਾਤਰ ਤਾਂ ਕਿਸਾਨ ਜੋ ਹੈਗੇ ਆ ਜ਼ਮੀਨ ਦੇ ਵਿੱਚੋਂ ਹੀ ਪਾਣੀ ਲੈਂਦੇ ਨੇ ਮੋਟਰਾਂ ਵਿੱਚੋਂ ਜਿਹੜੀਆਂ ਉਹਨਾਂ ਨੇ ਮੋਟਰ ਲਗਾਈਆਂ ਹੁੰਦੀਆਂ ਅਤੇ ਜ਼ਿਆਦਾਤਰ ਕਿਸਾਨ ਉੱਥੋਂ ਹੀ ਲੈਂਦੇ ਨੇ ਪਾਣੀ ਆਪੇ ਖੇਤੀਬਾੜੀ ਨੂੰ ਪਾਣੀ ਦਾ ਉਹ ਨਿੱਜੀ ਆਪਣਾ ਸਮਾਨ ਵਗੈਰਾ ਲਾਉਂਦੇ ਨੇ ਕੁਛ ਵੀ ਉਗਾਉਂਦੇ ਨੇ ਤਾਂ ਉਹਨੂੰ ਪਾਣੀ ਹੈ ਜਿਹੜਾ ਮੋਟਰ ਦੇ ਥਰੂ ਮਿਲਦਾ ਜੋ ਕਿ ਇੱਕ ਬੋਰਵੈਲ ਕਰਵਾ ਕੇ ਪਹਿਲਾਂ ਡੀਪਲੀ ਬਹੁਤ ਸਾਰਾ ਡੂੰਘਾ ਡੂੰਘਾਈ 'ਚ ਜਾ ਕੇ ਦੈਨ ਮੋਟਰ ਦੇ ਵਿੱਚੋਂ ਪਾਣੀ ਨਿਕਲਦਾ ਅਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹੁਣ ਜਿਹੜਾ ਪਾਣੀ ਆ ਉਹ ਖਤਮ ਹੋ ਰਿਹਾ ਜ਼ਮੀਨਾਂ ਵਿੱਚੋਂ ਅਤੇ ਮੋਟਰਾਂ ਬਹੁਤ ਸਾਰੀਆਂ ਸੁੱਕ ਰਹੀਆਂ ਨੇ ਜਿੱਥੋਂ ਪਾਣੀ ਨਹੀਂ ਨਿਕਲ ਰਿਹਾ ਬੰਦ ਹੋ ਚੁੱਕੀਆਂ ਮੋਟਰਾਂ ਅਤੇ ਪਾਣੀ ਦੀ ਘਾਟ ਹੋ ਰਹੀ ਹੈ ਅਤੇ ਥੱਲਿਓਂ ਹੋਰ ਡੂੰਘਾਈ 'ਚ ਜਾਣਾ ਪੈ ਰਿਹਾ ਜਿਸ ਕਰਕੇ ਪਾਣੀ ਬਹੁਤ ਥੱਲੇ ਨੀਵੇਂ ਪੱਧਰ 'ਤੇ ਚੱਲ ਗਿਆ ਅਤੇ ਇਹੀ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਮਾਨ ਸਰਕਾਰ ਨੇ ਇੱਕ ਫੈਸਲਾ ਲਿੱਤਾ ਵੀ ਜੋ ਆਪਾਂ ਜੀਰੀਆਂ ਉਗਾਉਂਦੇ ਹੁੰਦੇ ਹਾਂ ਉਸ ਨੂੰ ਜੁਲਾਈ ਦੇ ਵਿੱਚ ਥੋੜ੍ਹਾ ਲੇਟ ਉਗਾਉ ਵੀ ਜਿਸ ਨਾਲ ਆਪਾਂ ਨੂੰ ਜੋ ਪਾਣੀ ਹੈ ਵਰਖਾ ਹੁੰਦੀ ਹੈ ਉਹਦਾ ਵੀ ਆਪਾਂ ਫਾਇਦਾ ਲੈ ਚੱਕੀਏ ਵੀ ਅੱਗੇ ਜੀਰੀ ਲਾਉਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਪਾਣੀ ਦੀ ਜਿਹੜੀ ਘੱਟ ਤੋਂ ਘੱਟ ਵਰਤੋਂ ਹੋਵੇ ਅਤੇ ਜਿਹੜਾ ਬਾਰਿਸ਼ ਵਾਲਾ ਪਾਣੀ ਆ ਆਪਾਂ ਉਸ ਦੀ ਹੈਲਪ ਲੈ ਕੇ ਜਿਹੜਾ ਆਪਾਂ ਐਡ ਕਰ ਸਕਦੇ ਹਾਂ ਜਿਹਦੇ ਵਿੱਚ ਜੀਰੀ ਦੇ ਵਿੱਚ ਪਾਣੀ ਘੱਟ ਥੱਲੋਂ ਅਤੇ ਜਿਹੜਾ ਕੁਦਰਤੀ ਉੱਪਰੋਂ ਮੀਂਹ ਵਾਲਾ ਪਾਣੀ ਹੋਊਗਾ ਉਹਦੀ ਹੈਲਪ ਆਪਾਂ ਲੈ ਸਕਦੇ ਹਾਂ ਜਿਸ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਧਰਤੀ ਨੂੰ ਵੀ ਫਾਇਦਾ ਅਤੇ ਜਿਸ ਇਸ ਇਸ ਨਾਲ ਆਪਾਂ ਕਰਕੇ ਜੋ ਵੀ ਜ਼ਮੀਨ ਦੇ ਵਿੱਚ ਆਪਣਾ ਪਾਣੀ ਹੈ ਉਹਨੂੰ ਬਚਾ ਸਕਦੇ ਹਾਂ ਅਤੇ ਜੋ ਆਪਣਾ ਕੁਦਰਤੀ ਪਾਣੀ ਆਉਣਾ ਉੱਪਰ ਮੀਂਹ ਨਾਲ ਅਤੇ ਉਹਦੀ ਹੈਲਪ ਨਾਲ ਆਪਾਂ ਆਪਣਾ ਸਾਰਾ ਕੁਛ ਉਗਾ ਸਕਦੇ ਹਾਂ ਅਤੇ ਇਹ ਚੀਜ਼ਾਂ ਨਾਲ ਅਤੇ ਸੂਈ ਅਤੇ ਸੂਏ ਦੇ ਥਰੂ ਜਿੱਥੇ ਮੋਟਰਾਂ ਨਹੀਂ ਹੁੰਦੀਆਂ ਤਾਂ ਉਹਨੂੰ ਸੂਏ ਦੇ ਥਰੂ ਪਾਣੀ ਦਿੱਤਾ ਜਾਂਦਾ ਸੂਏ ਦੇ ਸਾਈਡ ਤੋਂ ਪਾ ਕੇ ਵਾਰੀਆਂ ਬੰਨ੍ਹ ਕੇ ਦੈਨ ਉਹਨਾਂ ਨੂੰ ਸੂਏ ਵਾਲਾ ਪਾਣੀ ਜੋ ਹੈ ਪ੍ਰਦਾਨ ਕੀਤਾ ਜਾਂਦਾ ਜਿਸ ਨਾਲ ਉਹ ਅੱਗੇ ਆਪਣੀਆਂ ਖੇਤੀਬਾੜੀ ਉਗਾਉਂਦੇ ਹਨ